ਮੈਂ ਚਿੱਤਰਕਾਰੀ ਨੂੰ ਇੱਕ ਪੇਸ਼ੇ ਵਜੋਂ ਲੈਣਾ ਚਾਹੁੰਦਾ ਹਾਂ ਚਿੱਤਰਕਾਰੀ ਦੇ ਕਿੱਤੇ ਨੂੰ ਅੱਜ ਕੱਲ੍ਹ ਬਹੁਤ ਪਹਿਲ ਦਿੱਤੀ ਜਾ ਰਹੀ ਹੈ ਪਰ ਇਸ ਵਿੱਚ ਬਹੁਤ ਸਾਰੀਆਂ ਚੁਣੋਤੀਆਂ ਵੀ ਹਨ ਜਿਵੇਂ ਸ਼ੁਰੂਆਤੀ ਦਿਨਾਂ ਵਿੱਚ ਕੰਮ ਦੀ ਦਿੱਕਤ ਆਉਣਾ ਕੰਮ ਦੌਰਾਨ ਵਰਤੇ ਜਾਂਦੇ ਸਮਾਨ ਦਾ ਮਹਿੰਗਾ ਹੋਣਾ